ਰਾਜ ਸਰਕਾਰ ਪੰਜਾਬ ਦੇ ਵੱਖ ਵੱਖ ਨੀਤੀਗਤ ਮੁੱਦਿਆਂ ਅਤੇ ਸਿੱਖਿਆ ਦੇ ਮਾਮਲੇ ਦੇ ਵਿੱਚ ਹਰੇਕ ਬੰਦੇ ਨੂੰ ਹਰੇਕ ਇਨਸਾਨ ਨੂੰ ਵਾਤਾਵਰਨ ਦੇ ਅਨੁਸਾਰ ਸਿੱਖਿਆ ਦਿੱਤੀ ਜਾਵੇ ਤਾਂ ਜੋ ਜਿਹੜੇ ਵਾਤਵਰਨ ਦੇ ਮਾੜੇ ਹਾਲਾਤ ਨੇ ਉਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਠੀਕ ਹੈ ਇਸ ਦੇ ਦੌਰਾਨ ਕੋਈ ਵੀ ਆਪਣਾ ਵਾਤਾਵਰਨ ਦੇ ਲਈ ਕੋਈ ਵੀ ਹਵਾ ਦਾ ਪ੍ਰਦੂਸ਼ਣ ਹੋ ਗਿਆ ਜਾਂ ਫੇਰ ਆਪਣੇ ਪਾਣੀ ਦਾ ਪ੍ਰਦੂਸ਼ਣ ਹੋ ਗਿਆ ਉਸਨੂੰ ਘੱਟ ਕੀਤਾ ਜਾਵੇ ਅਤੇ ਇਸ ਦੇ ਦੌਰਾਨ ਇਸ ਨੂੰ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਵੀ ਆਪਣੇ ਵਾਹਨ ਨੇ ਉਹ ਚਾਰਜੇਬਲ ਚਲਾਏ ਜਾਣ ਅਤੇ ਇਹ ਕਾਨੂੰਨ ਬਣਾਇਆ ਜਾਵੇ ਕਿ ਵਾਤਾਵਰਨ ਦੀ ਜਿਹੜੀ ਸ਼ੁੱਧਤਾ ਹੈ ਉਹ ਬਰਕਰਾਰ ਰੱਖੀ ਜਾਵੇ